ਹੈਲੋ ਸਰ ਐਮਾਜੋਨ ਤੋਂ ਬੋਲ ਰਹੇ ਜੀ ਸਰ ਮੈਂ ਨਾ ਤੁਹਾਡੇ ਕੋਲ ਸ਼ਰਟ ਇਕ ਬਾਏ ਕੀਤੀ ਸੀ ਔਨਲਾਈਨ ਮੈਂ ਤੁਹਾਡੇ ਕੋਲ ਖਰੀਦੀ ਸੀ ਇੱਕ ਸ਼ਰਟ ਮੈਂ ਨਾ ਉਸ ਸ਼ਰਟ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਸ ਸ਼ਰਟ ਦੇ ਤਜਰਬੇ ਬਾਰੇ ਕਿ ਉਹ ਸ਼ਰਟ ਬਹੁਤ ਵਧੀਆ ਸਰ ਉਹਦਾ ਫੈਬਰਿਕ ਆ ਬਹੁਤ ਵਧੀਆ ਮਤਲਬ ਕਿ ਉਹ ਰਹੀ ਆ ਜਿਸ ਤਰ੍ਹਾਂ ਉਹਦਾ ਰੰਗ ਸੀ ਉਹ ਬਿਲਕੁਲ ਫੈਡ ਨਹੀਂ ਹੋਇਆ ਹਾਂਜੀ ਅਤੇ ਜਿਸ ਤਰ੍ਹਾਂ ਕ ਮੈਂ ਇੱਥੇ ਬੜੀ ਟਰਾਈ ਕੀਤੀ ਹੁਣ ਮੈਂ ਉਹ ਚੀਜ਼ ਲੈਣ ਦੀ ਸੇਮ ਫੈਬਰਿਕ ਤੇ ਪਰ ਉਹ ਚੀਜ਼ ਇੱਥੋਂ ਮਿਲੀ ਨਹੀਂ ਹੈ ਮੇਰੇ ਸ਼ਹਿਰ 'ਚੋਂ ਮੈਂ ਬਹੁਤ ਘੁੰਮ ਕੇ ਵੇਖਿਆ ਜਾਂ ਹੋਰ ਸਾਈਡ ਵੀ ਵੇਖੀਆਂ ਉਹਨਾਂ 'ਤੇ ਚੈੱਕ ਕੀਤਾ ਪਰ ਕਿਤੋਂ ਨਹੀਂ ਮਿਲੀ ਅਰ ਜਿਸ ਤਰ੍ਹਾਂ ਹੁੰਦਾ ਨਾ ਕਦੇ ਕਦਾਈ ਇਹਨਾਂ ਨੂੰ ਕੱਪੜੇ ਧੋਣ ਨਾਲ ਵਾਰ ਵਾਰ ਜੋ ਕੱਪੜਾ ਧੋਂਦੇ ਉਹ ਦਾ ਰੰਗ ਫੈਡ ਹੁੰਦਾ ਪਰ ਇਹਦੀ ਚਮਕ ਆਉਂਦੀ ਆ ਜਿੰਨੀ ਵਾਰ ਧੋਈ ਸੋ ਤੁਹਾਡਾ ਬਹੁਤ ਵਧੀਆ ਇਹ ਪ੍ਰੋਡਕਟ ਸੀ ਬਹੁਤ ਵਧੀਆ ਅਤੇ ਇਹੋ ਐਕਸਪੀਰੀਅੰਸ ਆ ਮੇਰਾ ਤੁਹਾਡੇ ਨਾਲ